ਲੰਬੀ ਯਾਤਰਾ ਦੌਰਾਨ ਵੈਸੇ ਤਾਂ ਲੋਕ ਕਈ ਤਰ੍ਹਾਂ ਦੇ ਸਨੈਕਸ ਆਪਣੇ ਕੋਲ ਰੱਖਦੇ ਹਨ ਪਰ ਮੈਂ ਆਪਣੇ ਕੋਲ ਜ਼ਿਆਦਾਤਰ ਘਰ ਦਾ ਬਣਿਆ ਹੋਇਆ ਭੋਜਨ ਹੀ ਰੱਖਦਾ ਹਾਂ ਜੋ ਕਿ ਮੈਨੂੰ ਬੜਾ ਤੰਦਰੁਸਤ ਲੱਗਦਾ ਹੈ